ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਇੱਕ ਕੈਬ ਬੁੱਕ ਕਰਵਾਉਣੀ ਆ ਜੀ ਕੱਲ੍ਹ ਦੇ ਲਈ ਅਡਵਾਂਸ ਦੇ ਵਿੱਚ ਹਾਂਜੀ ਸਤਾਰ੍ਹਾਂ ਤਰੀਕ ਲਈ ਹਾਂਜੀ ਮੈਂ ਐਕਚੁਲੀ ਕੈਬ ਬੁੱਕ ਕਰਵਾਉਣੀ ਹੈ ਚਿਤਕਾਰਾ ਕੋਲਜ ਪਹੁੰਚਣਾ ਜੀ ਚੰਡੀਗੜ੍ਹ ਮੇਰਾ ਪੇਪਰ ਹੈ ਜੀ ਇਗਜ਼ਾਮ ਹੈ ਜਿਸ ਦੇ ਵਿੱਚ ਮੈਨੂੰ ਘੰਟਾ ਪਹਿਲਾਂ ਪਹੁੰਚਣਾ ਜ਼ਰੂਰੀ ਹੈ ਘੰਟਾ ਪਹਿਲਾਂ ਮੇਰੀ ਐਂਟਰੀ ਹੈਗੀ ਹੈ ਅਤੇ ਸਾਢੇ ਕੁ ਦਸ ਵਜੇ ਮੇਰਾ ਪੇਪਰ ਸਟਾਰਟ ਹੋਣਾ ਸੋ ਮੈਂ ਔਨਲਾਈਨ ਚੈੱਕ ਕਰ ਰਹੀ ਸੀ ਕਿ ਫਤਿਹਗੜ੍ਹ ਸਾਹਿਬ ਤੋਂ ਅਤੇ ਚ ਚਿਤਕਾਰਾ ਕੋਲੇਜ ਦਾ ਜਿਹੜਾ ਡਿਸਟੈਂਸ ਹੈ ਉਹ ਘੰਟੇ ਕੁ ਦਾ ਏ ਤਾਂ ਜਿਹੜੇ ਤੁਸੀਂ ਮੇਰੀ ਮੈਨੂੰ ਤੁਸੀਂ ਪਿੱਕ ਕਰਨਾ ਫਤਿਹਗੜ੍ਹ ਸਾਹਿਬ ਤੋਂ ਸਾਢੇ ਕੁ ਅੱਠ ਵਜੇ ਪਿੱਕ ਕਰਿਓ ਸਾਢੇ ਕੁ ਨੌ ਵਜੇ ਤੱਕ ਆਪਾਂ ਉੱਥੇ ਪਹੁੰਚ ਜਾਂਗੇ ਅਤੇ ਮੇਰੀ ਘੰਟਾ ਪਹਿਲਾਂ ਐਂਟਰੀ ਹੋਜੂਗੀ ਕਿਉਂਕਿ ਜਿਹੜਾ ਮੇਰਾ ਪੇਪਰ ਹੈ ਉਹ ਸਾਢੇ ਕੁ ਦਸ ਵਜੇ ਸਟਾਰਟ ਹੈ ਜੀ